ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਨਾਮ ਕਮਲਪ੍ਰੀਤ ਕੌਰ ਹੈ ਅਤੇ ਅਸੀਂ ਅਰਬਨ ਸਟੇਟ ਤੋਂ ਬੋਲ ਰਹੇ ਹਾਂ ਅਸੀਂ ਕੁਛ ਸੌਦੇ ਤੁਹਾਡੇ ਤੋਂ ਔਡਰ ਕਰਵਾਉਣੇ ਸੀਗੇ ਕੀ ਤੁਸੀਂ ਹਾਂਜੀ ਸਾਨੂੰ ਪੰਜ ਕਿਲੋ ਚੀਨੀ ਅਤੇ ਦਸ ਪੈਕਟ ਦੁੱਧ ਦੇ ਅਤੇ ਦਸ ਕਿਲੋ ਚੌਲ ਚਾਹੀਦੇ ਸੀਗੇ ਇਹਨਾਂ ਦੇ ਤੁਹਾਡੇ ਕੋਲੇ ਕੀ ਕੀ ਰੇਟ ਨੇ ਠੀਕ ਹੈ ਜੀ ਹਾਂ ਹਾਂਜੀ ਸਾਨੂੰ ਫੁੱਲ ਬਾਸਮਤੀ ਹੀ ਚਾਹੀਦੇ ਨੇ ਹਾਂਜੀ

ਠੀਕ ਹੈ ਜੀ ਅਤੇ ਰੇ ਇਹ ਰੇਟ ਕੁਛ ਥੋੜ੍ਹੇ ਘੱਟ ਹੋ ਸਕਦੇ ਨੇ ਸਾਨੂੰ ਰੇਟ ਮਤਲਬ ਕਿ ਲੋਕਲ ਮਾਰਕੀਟ ਦੇ ਨਾਲ ਥੋੜ੍ਹਾ ਜ਼ਿਆਦਾ ਲੱਗ ਰਹੇ ਨੇ ਕੋਈ ਡਿਸਕਾਊਂਟ ਮਿਲ ਸਕਦਾ ਹੋਵੇ ਹਾਂਜੀ ਹਾਂਜੀ ਇਮੀਡੀਏਟ ਪੇਮੈਂਟ ਹੀ ਕਰਾਂਗੇ ਮੈਂ ਤੁਹਾਨੂੰ ਗੂਗਲ ਪੇ ਕਰ ਦਾਂਗੀ ਪਰ ਦੇਖ ਲਓ ਜੇ ਕੁਝ ਹੋਰ ਡਿਸਕਾਊਂਟ ਦੀ ਗੁੰਜਾਇਸ਼ ਹੋਵੇ ਤਾਂ ਠੀਕ ਹੈ ਜੀ ਅਤੇ ਤੁਸੀਂ ਇਹ ਘਰ ਪੁੱਜਦਾ ਕਰਵਾ ਦੋਂਗੇ ਇਹ ਘਰੇ ਉਪਲਬਧ ਹੋ ਜਾਊਗਾ

ਕਿੰਨੇ ਕੁ ਐਕਸਟਰਾ ਚਾਰਜਿਜ ਹੋਣਗੇ ਅੱਗੇ ਆਪਾਂ ਅਰਬਨ ਸਟੇਟ ਮੰਗਵਾਉਣਾ ਹੋਵੇ ਦੋ ਫੇਸ 'ਚ ਐਕਸਟਰਾ ਚਾਰਜਿਜ ਤਾਂ ਬਹੁਤ ਜ਼ਿਆਦਾ ਨੇ ਦੇਖ ਲਓ ਤੁਸੀਂ ਆਪਾਂ ਸੌਦੇ ਦੇ ਰੇਟ ਚਲੋ ਠੀਕ ਹੈ ਤੁਹਾਡੇ ਹੈ ਨਾ ਡਿਸਕਾਊਂਟ ਜੋ ਦਿੱਤਾ ਉਹਦੇ ਉੱਤੇ ਸਾਨੂੰ ਮਨਜ਼ੂਰ ਹੈ ਬਟ ਐਕਸਟਰਾ ਚਾਰਜਿਜ ਜਿਹੜਾ ਤੁਸੀਂ ਟਰੈਵਲਿੰਗ ਦੇ ਲੈ ਰਹੇ ਓਂ ਉਹ ਥੋੜ੍ਹੇ ਜਿਹੇ ਤੁਸੀਂ ਸੌ ਕੁ ਰੁਪਏ ਤੱਕ ਜੇ ਕਰ ਦਿਓ ਚਲੋ ਠੀਕ ਹੈ ਤੁਸੀਂ ਇਹ ਕਿੰਨੇ ਕੁ ਦੇਰ ਦੇ ਵਿੱਚ ਸਾਡੇ ਘਰ ਪਹੁੰਚਾ ਦੋਂਗੇ ਹਾਂਜੀ ਹਾਂਜੀ ਮੈਂ ਤੁਹਾਨੂੰ ਐਡਰੈਸ ਹੈ ਜਿਹੜਾ ਉਹ ਵਟਸਐਪ ਕਰ ਦਿੰਦੀ ਹਾਂ ਅਤੇ ਜਦੋਂ ਵੀ ਤੁਹਾਡਾ ਸਮਾਨ ਆ ਸਾਨੂੰ ਮਿਲ ਜੂਗਾ ਘਰ ਮੈਂ ਨਾਲ ਦੀ ਨਾਲ ਤੁਹਾਨੂੰ ਇਹ ਜਿਹੜਾ ਉਹ ਜੀ ਪੇ ਕਰ ਦਾਂਗੀ ਤੁਸੀਂ ਸਾਨੂੰ ਨਾਲ ਸਕੈਨਰ ਭਿਜਵਾ ਦਿਓ ਠੀਕ ਹੈ ਜੀ ਠੀਕ ਹੈ ਧੰਨਵਾਦ ਹਾਂਜੀ

ਹਾਂਜੀ ਠੀਕ ਹੈ ਜੀ ਕੋਈ ਨਹੀਂ ਅਸੀਂ ਕੈਸ਼ ਪੇਮੈਂਟ ਕਰ ਦਾਂਗੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਠੀਕ ਹੈ ਜੀ ਓਕੇ ਥੈਂਕ ਯੂ